ਹੈਲੋ ਗੁਡ ਆਫਟਰਨੂਨ ਸਰ ਸਰ ਮੇਰਾ ਨਾਮ ਨਵਜੋਤ ਹੈ ਮੈਂ ਇੱਕ ਬਲੋਗਰ ਹਾਂ ਮੈਂ ਤੁਹਾਨੂੰ ਇੱਕ ਕੁਐਸ਼ਨ ਕਰਨਾ ਚਾਹੁੰਦੀ ਹਾਂ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿੰਨੀ ਵੀ ਨਿਊ ਜਨਰੇਸ਼ਨ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਾਡੇ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਉਹ ਤਾਂ ਫੋਰਨ ਜਾ ਰਹੇ ਆ ਤੁਹਾਡੇ ਇਸ ਬਾਰੇ ਕੀ ਵਿਊਜ ਹਨ ਹਾਂਜੀ ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਜੀ ਜੀ

ਜੀ ਜੀ ਜੀ ਜੀ

ਜੀ ਜੀ ਜੀ ਕੀ ਤੁਹਾਨੂੰ ਇਹ ਵੀ ਲੱਗਦਾ ਆ ਕਿ ਸਾਡੇ ਇੱਥੇ ਬੇਰੁਜ਼ਗਾਰੀ ਜ਼ਿਆਦਾ ਹੋਣ ਦੇ ਕਾਰਨ ਬੱਚੇ ਬਾਹਰ ਜਾਂਦੇ ਨੇ

ਜੀ ਜੀ ਥੈਂਕ ਯੂ ਓਕੇ ਸਰ ਥੈਂਕ ਯੂ ਜੀ ਥੈਂਕ ਯੂ ਓਕੇ ਓਕੇ